ਡਰੋਇੰਗ ਅਤੇ ਪੇਂਟਿੰਗ ਵਰਗੀਆਂ ਕਲਾਵਾਂ ਸ਼ੁਰੂ ਕਰਨ ਲਈ ਮੇਰੇ ਹਿਸਾਬ ਨਾਲ ਕੋਈ ਵੀ ਉਮਰ ਨਹੀਂ ਹੁੰਦੀ ਹਰੇਕ ਉਮਰ ਦਾ ਬੱਚਾ ਬੁੱਢਾ ਯੰਗਰ ਐਲਡਰਸ ਕੋਈ ਵੀ ਮਤਲਬ ਕਿ ਡਰੋਇੰਗ ਕਰ ਸਕਦੇ ਆ ਡਰੋਇੰਗ ਇੱਕ ਜ਼ਰੀਆ ਹੈਗਾ ਜਿਹਦੇ ਨਾਲ ਮਤਲਬ ਕਿ ਆਪਾਂ ਆਪਣੀ ਫੀਲਿੰਗਸ ਨੂੰ ਐਕਸਪਲੇਨ ਕਰ ਸਕਦੇ ਹਾਂ ਆਪਣਾ ਪ ਪੁਆਇੰਟ ਔਫ ਵਿਊਇੰਗ ਪੁਆਇੰਟ ਔਫ ਇਮੈਜਿੰਗ ਨੂੰ ਮਤਲਵ ਕਿ ਬਣਾ ਕੇ ਦਿਖਾ ਸਕਦੇ ਹਾਂ ਕਿਸੇ ਨੂੰ ਵੀ ਡਰੋਇੰਗ ਸਿੱਖਣ ਲਈ ਆਪਾਂ ਨੂੰ ਮਤਲਬ ਕੋਈ ਵੀ ਉਮਰ ਨਹੀਂ ਚਾਹੀਦੀ ਇੱਕ ਸਪੈਸੀਫਿਕ ਏਜ ਨਹੀਂ ਹੈਗੀ ਕਿ ਹਾਂ ਆਪਾਂ ਕਹਿ ਸਕਦੇ ਹਾਂ ਕਿ ਹਾਂ ਇੱਕ ਤੀਹ ਸਾਲ ਦਾ ਬੰਦਾ ਇੱਕ ਚਾਲੀ ਸਾਲ ਦਾ ਬੰਦਾ ਹੀ ਡਰੋਇੰਗ ਕਰ ਸਕਦਾ ਨਹੀਂ ਕੋਈ ਵੀ ਫਸਟ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਬਾਰਵੀਂ ਕਲਾਸ ਕੋਈ ਵੀ ਕਲਾਸ ਦਾ ਬੱਚਾ ਜਾਂ ਮਤਲਬ ਕਿ ਕੋਈ ਵੀ ਐਲਡਰ ਮਤਲਬ ਡਰੋਇੰਗ ਕਰ ਸਕਦੇ ਹਾਂ ਮੈਨੂੰ ਵੀ ਡਰੋਇੰਗ ਕਰਨਾ ਬਹੁਤ ਪਸੰਦ ਹੈਗਾ ਹੈ ਮੈਂ ਮਤਲਬ ਕਿ ਮੋਸਟਲੀ ਡਰੋਇੰਗ ਕਰਦੀ ਰਹਿੰਦੀ ਹਾਂ ਜਿਵੇਂ ਮਤਲਬ ਕਿ ਕੋਈ ਲੈਂਡਸਕੇਪਸ ਹੋ ਗਿਆ ਜਾਂ ਕਿਹੇ ਕਿਸੇ ਦੀ ਪਿਕਚਰ ਬਣਾਉਣੀ ਟੈਡੀ ਬਿਅਰਸ ਬਣਾਉਣੇ ਫਲਾਵਰਸ ਬਣਾਉਣੇ ਮੈਨੂੰ ਵੀ ਬਹੁਤ ਜ਼ਿਆਦਾ ਪਸੰਦ ਹੈਗੇ ਆ ਠੀਕ ਆ ਅ ਡਰੋਇੰਗ ਡਰੋਇੰਗ ਕਰਨ ਨਾਲ ਮਤਲਬ ਮੈਨੂੰ ਬੜੀ ਜ਼ਿਆਦਾ ਖੁਸ਼ੀ ਮਿਲਦੀ ਹੈ ਮੈਂ ਜੋ ਮੈਂ ਸੋਚਦੀ ਹਾਂ ਮੈਂ ਉਹਨੂੰ ਇਮੈਜਨ ਕਰਦੀ ਹਾਂ ਮੈਂ ਉਸ ਚੀਜ਼ ਨੂੰ ਬਣਾਉਂਦੀ ਹਾਂ ਠੀਕ ਆ ਅਗਾਂਹ ਫਿਰ ਮਤਲਬ ਕਿ ਅੱਗੇ ਜਾ ਕੇ ਮੈਨੂੰ ਬੜੀ ਜ਼ਿਆਦਾ ਮਤਲਬ ਖੁਸ਼ੀ ਵੀ ਮਿਲਦੀ ਆ ਮੇਰੀ ਕਲਾਸ ਵਿੱਚ ਵੀ ਮੈਨੂੰ ਸਾਰੇ ਜਾਣੇ ਕਹਿੰਦੇ ਰਹਿੰਦੇ ਤੂੰ ਮੇਰੀ ਪਿਕਚਰ ਬਣਾ ਤੂੰ ਆ ਕਰ ਟੈਟੂਜ ਬਣਾ ਦੈਟਸ ਐਂਡ ਦੈਟਸ ਸੋ ਮਤਲਬ ਕਿ ਹਾਂ ਮੇਰੇ ਹਿਸਾਬ ਨਾਲ ਕੋਈ ਵੀ ਡਰੋਇੰਗ ਕਰਨ ਦੀ ਉਮਰ ਨਹੀਂ ਹੈਗੀ ਆਪਾਂ ਨੂੰ ਮਤਲਬ ਡਰੋਇੰਗ ਕਰਨ ਵਾਸਤੇ ਹੀ ਡਰੋਇੰਗ ਕਰਨ ਵਾਸਤੇ ਆਪਾਂ ਨੂੰ ਇੱਕ ਨਾ ਹੀ ਕੋਈ ਕਲਾਸਿਸ ਲੈਣੀਆਂ ਪੈਂਦੀਆਂ ਹੈ ਨਾ ਹੀ ਆਪਾਂ ਨੂੰ ਕੋਈ ਸੈਂਟਰਸ ਜਾਣਾ ਪੈਂਦਾ ਹੈ ਕੁਝ ਨਹੀਂ ਕਰਨਾ ਚਾਹੀਦਾ ਇਹ ਸਿਰਫ਼ ਆਪਣੀ ਇੱਕ ਦਿਮਾਗ ਦੀ ਕਲਾ ਹੁੰਦੀ ਹੈ ਕਿ ਮਤਲਬ ਕੁਦਰਤੀ ਕਲਾ ਹੈਗੀ ਹੈ ਜਿਹੜੀ ਆਪਾਂ ਨੂੰ ਮਿਲਦੀ ਹੈ ਕਿ ਆਪਾਂ ਮਤਲਬ ਕਿ ਡਰੋਇੰਗ ਕਰਦੇ ਹਾਂ ਆਪਾਂ ਨੂੰ ਉਹਦੇ ਨਾਲ ਇੰਟਰਸਟਿੰਗ ਫੀਲਿੰਗ ਹੁੰਦਾ ਥੋੜ੍ਹਾ ਆਪਾਂ ਆਪਣੇ ਆਪ ਨੂੰ ਲੈਸ ਡਿਪਰੈਸ਼ਨ ਡਿਪਰੈਸ ਫੀਲ ਕਰਦੇ ਹਾਂ ਅਗਰ ਮਤਲਬ ਆਪਾਂ ਇਕੱਲੇ ਬੈਠੇ ਹਾਂ ਤਾਂ ਆਪਾਂ ਡਰੋਇੰਗ ਬਣਾ ਸਕਦੇ ਹਾਂ ਜਿਹਦੇ ਨਾਲ ਸਾਡਾ ਮਨੋਰੰਜਨ ਵੀ ਹੋ ਜਾਊਗਾ ਤਾਂ ਆਪਾਂ ਮਤਲਬ ਕਿ ਆਪਣੀ ਫੀਲਿੰਗ ਅਤੇ ਵਿਊਜ਼ ਨੂੰ ਐਕਸਪਲੇਨ ਕਰ ਸਕਦੇ ਹਾਂ ਅਗਲੇ ਬੰਦੇ ਨੂੰ ਲੈ ਕੇ